ਹੈਲੋ ਐਚ ਐਮ ਟੀ ਸਰ ਮੈਂ ਕੱਲ੍ਹ ਤੁਹਾਡੇ ਤੋਂ ਚੋਕਲੇਟ ਕੇਕ ਮੰਗਾਇਆ ਸੀ ਸਰ ਉਹ ਬਹੁਤ ਟੇਸਟੀ ਸੀਗਾ ਅੱਜ ਸ਼ਾਮੀ ਮੇਰੇ ਘਰ ਗੈਸਟ ਆ ਰਹੇ ਆ ਪਲੀਜ਼ ਤੁਸੀਂ ਉਹੀ ਮੈਨੂੰ ਚੋਕਲੇਟ ਕੇਕ ਵਾਪਸ ਭੇਜ ਦਿਉ ਔਰ ਮੇਰਾ ਘਰ ਦਾ ਪਤਾ ਹੈ ਹਾਊਸ ਨੰਬਰ ਪੰਤਾਲੀ ਲਖਵਿੰਦਰਾ ਇੰਨਕਲੈਵ